ਸਤਿ ਸ਼੍ਰੀ ਅਕਾਲ ਬੇਟੇ ਹਾਂਜੀ ਹਾਂਜੀ ਬੇਟੇ ਵਧੀਆ ਹਾਂਜੀ ਸਾਰੇ ਤੁਸੀਂ ਦੱਸੋ ਕਿਵੇਂ ਤੁਹਾਡੀ ਮੰਮੀ ਹੋਣੀ ਠੀਕ ਆ ਸਾਰੇ ਹਾਂਜੀ ਹੋਰ ਦੱਸੋ ਕਿਵੇਂ ਹਾਂਜੀ ਹਾਂਜੀ ਹਾਂਜੀ ਹਾਂਜੀ ਬੇਟੇ ਜਿਵੇਂ ਮੰਨ ਲਓ ਆਪਣੇ ਹਾਂਜੀ ਹਾਂਜੀ ਹਾਂਜੀ ਹਾਂਜੀ

ਆਪਣੇ ਤਾਂ ਜਿਵੇਂ ਸਬਜ਼ੀ ਮੰਡੀ ਹੈਗੀ ਆ ਦਾਣਾ ਮੰਡੀ ਕੋਲ ਸਬਜ਼ੀ ਮੰਡੀ ਦੇ ਵਿੱਚੋਂ ਆਪਾਂ ਫਰੈਸ਼ ਸਬਜ਼ੀ ਲੈ ਸਕਦੇ ਹਾਂ ਦਾਣਾ ਮੰਡੀ ਕੋਲ ਹੈਗੀ ਆ ਸਬਜ਼ੀ ਮੰਡੀ ਹਾਂਜੀ ਦੇਖ ਕੇ ਨਾ ਇੱਕ ਮੰਡੀ ਸੀਟੀ ਕੋਲ ਹੈਗੀ ਆ ਹਾਂਜੀ ਅਤੇ ਇੱਕ ਆਪਣੇ ਵੈਸੇ ਤਾਂ ਆਪਣੇ ਘਰਾਂ ਕੋਲ ਇੱਧਰ ਰੇਹੜੀਆਂ ਵੀ ਲੱਗਦੀਆਂ ਬਠਿੰਡਾ ਰੋਡ 'ਤੇ ਆਪਾਂ ਉਹ ਤੋਂ ਵੀ ਫਰੈਸ਼ ਸਬਜ਼ੀ ਲੈ ਸਕਦੇ ਹਾਂ ਹਾਂਜੀ ਅਤੇ ਜਿਵੇਂ ਆਪਾਂ ਆਪਣੀ ਤਾਂ ਘਰ ਕੋਲ ਇੱਥੇ ਖੇਤ ਵੀ ਹੈਗਾ ਏ ਅਤੇ ਅਸੀਂ ਉਥੋਂ ਵੀ ਫਰੈਸ਼ ਸਬਜ਼ੀ ਲੈ ਆਉਂਦੇ ਹਾਂ ਅਤੇ ਜਾਂ ਕਦੇ ਵੀ ਵੈਸੇ ਤੋੜ ਕੇ ਵੀ ਫੜਾ ਜਾਂਦੇ ਆ ਆਪਣੀ ਘਰ ਕੋਈ ਵੀ ਚੀਜ਼ ਲੈਣੀ ਆ ਵੈਸੇ ਤਾਂ ਤੋੜ ਕੇ ਵੀ ਘਰ ਫੜਾ ਜਾਂਦੇ ਆ ਜੇ ਨਾ ਵੀ ਕਦੇ ਫੜਾ ਕੇ ਜਾਣ ਤਾਂ ਫਿਰ ਵੀ ਆਪ ਵੀ ਕਦੇ ਜਾ ਕੇ ਖੇਤ ਦੇ ਵਿੱਚ ਸਬਜ਼ੀ ਲੈ ਆਈ ਦੀ ਆ ਹਾਂਜੀ ਹਾਂਜੀ ਹਾਂਜੀ ਵਧੀਆ ਸਬਜ਼ੀ ਤਾਜ਼ੀ ਸਬਜ਼ੀ ਦੇਸੀ ਪਾਣੀ ਲੱਗਦਾ ਵਧੀਆ ਦੇਸੀ ਸਬਜ਼ੀ ਹਾਂਜੀ ਰੇਹ ਸਪਰੇ ਤੋਂ ਨਹੀਂ ਨਹੀਂ ਰੇਹ ਸਪਰੇ ਤੋਂ ਰਹਿਤ ਹਾਂਜੀ ਹਾਂਜੀ ਗੰਦੇ ਨਾਲੇ ਵਾਲੀਆਂ ਨਹੀਂ ਸਬਜ਼ੀ ਹ ਹਾਂਜੀ ਹਾਂਜੀ ਹਾਂਜੀ ਹਾਂ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਨਹੀਂ ਵੈਸੇ ਤਾਂ ਕੋਈ ਇੰਨੀ ਹੈ ਨਹੀਂ ਗਾ ਵੀ ਆਪਣੇ ਸਬਜ਼ੀਆਂ ਨੇ ਰੇਹੜੀਆਂ ਵੀ ਬਹੁਤ ਆਉਂਦੀਆਂ ਵੇਚਣ ਵਾਲੇ ਵੀ ਬਹੁਤ ਆਉਂਦੇ ਆ ਜੇ ਆਪਾਂ ਫਰੈਸ਼ ਸਬਜ਼ੀ ਲੈਣੀ ਆ ਤਾਂ ਆਪਣੇ ਵੀ ਤੁਹਾਨੂੰ ਦੱਸਿਆ ਆਪਣੇ ਘਰ ਦੇ ਕੋਲ ਖੇਤ ਆ ਅਤੇ ਕਿਸੇ ਤਰ੍ਹਾਂ ਦੀ ਹੋਰ ਵੀ ਦਿੱਕਤ ਆਉਂਦੀ ਹੈ ਤਾਂ ਤੁਸੀਂ ਘਰ ਵੀ ਆ ਸਕਦੇ ਆ ਸਬਜ਼ੀ ਲੈ ਕੇ ਵੀ ਜਾ ਸਕਦੇ ਹਾਂ ਵੀ ਸੌਖਾ ਹੋ ਜਾਂਦਾ ਜਿਵੇਂ ਸਾਗ ਵਗੈਰਾ ਮੂਲੀਆਂ ਅਤੇ ਇਹਨਾਂ ਨੇ ਬੀਜ ਰੱਖੀਆਂ ਇੱਥੇ ਆਪਣੇ ਘਰ ਕੋਲ

ਨਹੀਂ ਮੁਕਤਸਰ ਵੀ ਬਹੁਤ ਵਧੀਆ ਸਸਤਾ ਕੱਪੜਾ ਹਾਂਜੀ ਸਸਤਾ ਹੀ ਮਿਲ ਜਾਂਦਾ ਹਾਂਜੀ ਵਿਸ਼ਾਲ ਮਾਲ ਦੇ ਵਿੱਚ ਹਾਂਜੀ ਵਿਸ਼ਾਲ ਮਾਲ ਦੇ ਵਿੱਚ ਵੀ ਬਹੁਤ ਸਸਤਾ ਕੱਪੜਾ ਮਿਲ ਜਾਂਦਾ ਆਪਾਂ ਨੂੰ ਹਾਂਜੀ

ਹਾਂਜੀ ਸਬਜ਼ੀ ਬਸ ਸਬਜ਼ੀ ਮੰਡੀ 'ਚ ਜਾ ਕੇ ਲਿਆ ਸਕਦੇ ਆਪਾਂ ਫਰੈਸ਼ ਸਬਜ਼ੀ ਸੁਬਹਾ ਸੁਬਹਾ ਵੀ ਫਰੈਸ਼ ਇੱਥੇ ਮੰਨ ਲਾ ਟੁੱਟ ਕੇ ਜਾਂ ਆਉਂਦੀ ਹੈਗੀ ਆ ਤੋੜ ਕੇ ਖੇਤਾਂ ਦੇ ਵਿੱਚੋਂ ਲੈ ਕੇ ਆਉਂਦੇ ਫਰੈਸ਼ ਸਬਜ਼ੀ ਅਤੇ ਆਪਾਂ ਸਬਜ਼ੀ ਮੰਡੀ ਅਤੇ ਦਾਣਾ ਮੰਡੀ ਕੋਲੋਂ ਸਬਜ਼ੀ ਮੰਡੀ ਉੱਥੇ ਲਿ ਲਿਆ ਸਕਦੇ ਆ ਸਬਜ਼ੀ ਤਾਜ਼ੀ ਚਾਰ ਵਜੇ ਹਾਂਜੀ ਹਾਂ ਦਸ ਗਿਆਰ੍ਹਾਂ ਵਜੇ ਤੱਕਰ ਖੁੱਲ੍ਹੀ ਰਹਿੰਦੀ ਹੈ ਮੰਡੀ ਹਾਂ ਬੇਟੇ ਬਾਕੀ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਹੋਈ ਤਾਂ ਕੋਈ ਗੱਲ ਨਹੀਂ ਤੁਸੀਂ ਘਰ ਆ ਜੋ ਜੀ ਬੇਟੇ ਹਾਂ ਠੀਕ ਹੈ ਬੇਟਾ ਧੰਨਵਾਦ ਹਾਂਜੀ ਹਾਂਜੀ ਹਾਂਜੀ ਬੇਟੇ ਹਾਂਜੀ